ਸਾਡੇ ਭਾਰਤ ਵਿੱਚ ਵੱਖ ਵੱਖ ਤਰ੍ਹਾਂ ਦੇ ਬੈਂਕ ਹਨ ਜਿਹਦੇ ਵਿੱਚ ਅਸੀਂ ਆਪਣੇ ਪੈਸੇ ਜਮ੍ਹਾਂ ਕਰਵਾ ਸਕਦੇ ਹਾਂ ਅਤੇ ਲੋੜ ਪੈਣ 'ਤੇ ਅਸੀਂ ਉਨ੍ਹਾਂ ਨੂੰ ਕਢਾ ਵੀ ਸਕਦੇ ਹਾਂ ਬੈਂਕਾਂ ਵਿੱਚ ਬਹੁਤ ਸਾਰੀਆਂ ਸਕੀਮਾਂ ਵੀ ਹੁੰਦੀਆਂ ਹਨ ਜਿਵੇਂ ਕਿ ਐੱਫ ਡੀ ਮਤਲਬ ਅਸੀਂ ਫਿਕਸ ਆਪਣਾ ਪੈਸਾ ਜਮ੍ਹਾਂ ਕਰਾ ਸਕਦੇ ਹਨ ਇੱਕ ਜਾਂ ਦੋ ਸਾਲਾਂ ਵਾਸਤੇ ਅਤੇ ਵੱਧ ਸਾਲਾਂ ਵਾਸਤੇ ਅਤੇ ਆਰ ਡੀ ਜਿਹੜੀ ਕਿ ਅਸੀਂ ਅਸੀਂ ਤੁੜਵਾ ਸਕਦੇ ਹਨ ਲੋੜ ਪੈਣ 'ਤੇ